ਹਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਰਾਜ ਵਿੱਚ ਬਹੁਤ ਸਾਰੇ ਧਰਮ ਰਹਿੰਦੇ ਨੇ ਜਿੰਨ੍ਹਾਂ ਵਿੱਚੋਂ ਪ੍ਰਮੁੱਖ ਧਰਮ ਹਿੰਦੂ ਮੁਸਲਿਮ ਸਿੱਖ ਈਸਾਈ ਜੈਨ ਬੋਧ ਕਾਫ਼ੀ ਸਾਰੇ ਧਰਮ ਪੰਜਾਬ ਰਾਜ ਵਿੱਚ ਰਹਿੰਦੇ ਹਨ ਹਾਂ ਮੇਰੇ ਮੁਤਾਬਿਕ ਇਹ ਜਿੰਨੇ ਵੀ ਧਰਮ ਪੰਜਾਬ ਵਿੱਚ ਰਹਿ ਰਹੇ ਹਨ ਇਹਨਾਂ ਦੇ ਸਾਰੇ ਹੀ ਧਰਮਾਂ ਦੇ ਆਪਣੇ ਆਪਣੇ ਧਰਮ ਅਕੋਰਡਿੰਗ ਰੂਲ ਰੈਗੂਲੇਸ਼ਨ ਜਿਵੇਂ ਕਿ ਅਸੀਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਕਿ ਪੂਜਾ ਕਰਨ ਦੀ ਪੱਦਤੀ ਔਰ ਮੰਦਿਰ ਗੁਰਦੁਆਰਾ ਮਸਜਿਦ ਚਰਚ ਉਹਨਾਂ ਵਿੱਚ ਜਾ ਕੇ ਆਪਣੇ ਭਗਵਾਨ ਨੂੰ ਆਪਣੇ ਈਸਟ ਨੂੰ ਕਿਵੇਂ ਮਨਾਉਣਾ ਉਹਨਾਂ ਨੂੰ ਮਨਾਉਣ ਦੀ ਅਲੱਗ ਅਲੱਗ ਰੀਤੀ ਰਿਵਾਜ਼ ਨੇ ਹਰ ਧਰਮ ਦੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਅੱਜ ਦੇ ਟਾਈਮ 'ਤੇ ਧਰਮ ਦਾ ਪ੍ਰਚਾਰ ਕਾਫ਼ੀ ਤੇਜ਼ੀ ਨਾਲ ਹੋ ਰਿਹਾ ਹਰ ਇੱਕ ਧਰਮ ਦੇ ਲੋਕ ਜਿਹੜੇ ਆ ਉਹ ਆਪਣੇ ਧਰਮ ਨੂੰ ਲੋਕਾਂ ਤੋਂ ਦੂਸਰਿਆਂ ਦੇ ਧਰਮਾਂ ਨਾਲੋਂ ਕਾਫ਼ੀ ਅੱਗੇ ਦੇਖਣਾ ਚਾਹੁੰਦੇ ਆ ਜਿਹਦੇ ਕਰਕੇ ਕੁਝ ਧਰਮ ਦੇ ਲੋਕ ਧਰਮਾਂ ਦੇ ਲੋਕ ਦੂਸਰੇ ਧਰਮ ਨੂੰ ਮਾੜਾ ਵੀ ਕਹਿੰਦੇ ਆ ਜੋ ਕਿ ਨਹੀਂ ਹੋਣਾ ਚਾਹੀਦਾ ਲੇਕਿਨ ਹਾਂ ਇੱਕ ਸਿੱਕੇ ਦੇ ਜਿਵੇਂ ਦੋ ਪਹਿਲੂ ਹੁੰਦੇ ਆ ਜਿਵੇਂ ਹਰੇਕ ਸਮਾਜ ਵਿੱਚ ਜੇ ਚੰਗਾ ਧਰਮ ਹੈ ਅਤੇ ਉਸ 'ਚ ਚੰਗੇ ਲੋਕ ਵੀ ਆ ਮਾੜੇ ਲੋਕ ਵੀ ਆ ਧਰਮ ਤਾਂ ਚਲੋ ਸਾਰੇ ਹੀ ਚੰਗੇ ਹੁੰਦੇ ਆ ਲੇਕਿਨ ਧਰਮ ਵਿੱਚ ਜੇ ਕੁਝ ਚੰਗੇ ਲੋਕ ਹੋਣਗੇ ਉਹ ਚੰਗੀ ਗੱਲ ਕਰਨਗੇ ਮਾੜੇ ਲੋਕ ਹੋਣਗੇ ਤਾਂ ਮਾੜੀ ਲ ਗੱਲ ਕਰਨਗੇ ਮੇਰਾ ਸਾਰਿਆਂ ਨੂੰ ਸੁਨੇਹਾ ਇਹ ਹੀ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਜੋ ਧਰਮ ਆ ਉਹ ਸਾਨੂੰ ਰਹਿਣ ਦੀ ਖਾਣ ਦੀ ਪੀਣ ਦੀ ਸਿਕਸ਼ਾ ਵੀ ਦਿੰਦਾ ਹੈ ਸੋ ਧਰਮ ਦੇ ਨਾਮ 'ਤੇ ਕਿਸੇ ਨਾਲ ਲੜਾਈ ਝਗੜਾ ਬਿਲਕੁਲ ਨਹੀਂ ਕਰਨਾ ਚਾਹੀਦਾ ਸਾਨੂੰ ਕਿਉਂਕਿ ਜਿਹੜਾ ਧਰਮ ਆ ਉਹ ਬੰਦੇ ਨੂੰ ਜਿਉਣ ਦੀ ਜਾਂਚ ਦੱਸਦਾ ਹੈ ਬੰਦੇ ਨੂੰ ਅੱਗੇ ਵਧਣ ਦੀ ਜਾਂਚ ਦੱਸਦਾ ਸੋ ਸਾਰਿਆਂ ਨੂੰ ਸਾਨੂੰ ਚਾਹੀਦਾ ਕਿ ਆਪਣੇ ਆਪਣੇ ਧਰਮ ਦਾ ਸਤਿਕਾਰ ਕਰੀਏ ਅਤੇ ਦੂਸਰੇ ਧਰਮ ਦਾ ਕਦੇ ਵੀ ਨਿਰਾਦਰ ਅਸੀਂ ਨਾ ਕਰੀਏ